ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਜੋ ਸਾਨੂੰ ਗੁੜਤੀ ਵਿੱਚ ਹੀ ਮਿਲ ਜਾਂਦੀ ਬੱਚਾ ਜੋ ਵੀ ਪਹਿਲਾ ਅੱਖਰ ਆਪਣੀ ਜ਼ਿੰਦਗੀ ਦਾ ਬੋਲਦਾ ਹੈ ਉਹ ਉਸ ਦੀ ਮਾਤ ਭਾਸ਼ਾ ਹੀ ਹੁੰਦੀ ਹੈ ਅੱਜ ਪੰਜਾਬੀ ਭਾਸ਼ਾ ਨੂੰ ਵੀ ਆਪਣਾ ਦਰਜਾ ਮਿਲ ਚੁੱਕਾ ਹੈ ਪੰਜਾਬੀ ਬੋਲੀ ਦਾ ਵਿਰਸਾ ਬੜਾ ਅਮੀਰ ਹੈ ਇੱਥੇ ਦੇ ਕਈਆਂ ਕਵੀਆਂ ਸੰਤਾਂ ਸੂਫੀਆਂ ਕਹਾਣੀਕਾਰ ਨਾਵਲਕਾਰ ਆਦਿ ਦੇ ਆਪਣਾ ਸਾਹਿਤ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਬੋਲੀ ਦਾ ਮਾਣ ਵਧਾਇਆ ਹੈ ਅਤੇ ਸਭ ਤੋਂ ਵੱਧ ਯੋਗਦਾਨ ਸਾਡੇ ਦਸ ਗੁਰੂ ਸਾਹਿਬਾਨ ਦੀ ਅਲਾਹੀ ਬਾਣੀ ਗੁਰਮੁਖੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਲੋਕਾਂ ਤੱਕ ਪਹੁੰਚਾਇਆ ਸੋ ਜੋ ਅਸੀਂ ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਆਉਣੀ ਹੀ ਚਾਹੀਦੀ ਹੈ ਜਾਹਿਰ ਹੈ ਜਾਹਿਰ ਜਿਹੀ ਗੱਲ ਹੈ ਕਿ ਇਹ ਸਾਡੀ ਮਾਤ ਭਾਸ਼ਾ ਹੈ ਇਸ ਕਰਕੇ ਇਹ ਤਾਂ ਆਉਣੀ ਚਾਹੀਦੀ ਹੈ ਵੈਸੇ ਵੀ ਜਿੰਨੀ ਜਿੰਨਾਂ ਵੀ ਗਿਆਨ ਸਾਨੂੰ ਆਪਣੀ ਭਾਸ਼ਾ ਵਿੱਚ ਦਿੱਤਾ ਜਾਵੇ ਤਾਂ ਬਹੁਤ ਜਲਦੀ ਸਮਝ ਵਿੱਚ ਆ ਜਾਂਦਾ ਬੇਸ਼ੱਕ ਹੁਣ ਸਮਾਂ ਅਜਿਹਾ ਚੱਲ ਰਿਹਾ ਹੈ ਕਿ ਲੋਕ ਜਿਹੜਾ ਪੰਜਾਬੀ ਬੋਲੇ ਉਸਨੂੰ ਨਲਾਇਕ ਹੀ ਸਮਝਦੇ ਹਨ ਕਿ ਇਸ ਨੂੰ ਇੰਗਲਿਸ਼ ਨਹੀਂ ਆਉਂਦੀ ਇਹ ਪੰਜਾਬੀ 'ਚ ਗੱਲ ਕਰਦਾ ਹੈ ਵਿਦੇਸ਼ ਜਾਣ ਦੀ ਚਾਹਤ ਕਰਕੇ ਲੋਕਾਂ ਕੋਲ ਅੰਗਰੇਜ਼ੀ ਵਾਲੇ ਸਕੂਲ ਵਿੱਚ ਆਪਣੇ ਬੱਚੇ ਪੜ੍ਹਾਉਣਾ ਪਸੰਦ ਕਰਦੇ ਹਨ ਉਹਨਾਂ ਨੂੰ ਆਪਣਾ ਬੱਚਾ ਪੰਜਾਬੀ ਬੋਲਦਾ ਨਹੀਂ ਚਾਹੀਦਾ ਸਗੋਂ ਇੰਗਲਿਸ਼ ਜਾਂ ਹਿੰਦੀ ਵਿੱਚ ਗੱਲ ਕਰਨੀ ਪਸੰਦ ਕਰਦੇ ਹਨ ਜੋ ਕਿ ਬਿਲਕੁਲ ਗਲਤ ਹੈ ਬੇਸ਼ੱਕ ਸਾਡੀ ਬਾਕੀ ਭਾਸ਼ਾਵਾਂ ਵੀ ਸਾਨੂੰ ਸਿੱਖਣੀਆਂ ਚਾਹੀਦੀਆਂ ਹਨ ਪਰ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਅਤੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਬੋਲੀ ਸਿਖਾਉਣੀ ਚਾਹੀਦੀ ਹੈ